ਤੇਰਾਂ ਜੁਲਾਈ ਉੱਨੀ ਸੌ ਅਠਾਸੀ ਦਸ ਅਕਤੂਬਰ ਉੱਨੀ ਸੌ ਸਤਾਸੀ ਇੱਕ ਅਗਸਤ ਉੱਨੀ ਸੌ ਪਚਾਸੀ ਬਾਰਾਂ ਸਤੰਬਰ ਉੱਨੀ ਸੌ ਪਚਾਸੀ ਉੱਨੀ ਨਵੰਬਰ ਦੋ ਹਜ਼ਾਰ ਵੀਹ